ਮੇਰੀਆਂ ਮਨਪਸੰਦ ਕਿਤਾਬਾਂ ਕਹਾਣੀਆਂ ਤਾਂ ਵੈਸੇ ਕਾਫੀ ਨੇ ਪਰ ਮੈਂ ਅਜੇ ਤੱਕ ਕੋਈ ਕਿਤਾਬ ਜਾਂ ਕਹਾਣੀ ਤਾਂ ਨਹੀਂ ਲਿਖੀ ਪਰ ਮੈਂ ਗੀਤ ਕਵਿਤਾ ਇਹ ਲਿਖ ਲੈਂਦਾ ਮੇਰੇ ਆਪਣੇ ਲਿਖੇ ਗੀਤ ਕਵਿਤਾ ਕਈ ਸਾਰੀਆਂ ਮਨਪਸੰਦ ਨੇ ਮੈਨੂੰ ਆਪਣੀਆਂ ਵੈਸੇ ਮੈਨੂੰ ਸ਼ਿਵ ਕੁਮਾਰ ਦੀਆਂ ਲਿਖਤਾਂ ਬਹੁਤ ਪਸੰਦ ਨੇ ਅਤੇ ਮੈਂ ਸ਼ਿਵ ਕੁਮਾਰ ਜੀ ਦੀਆਂ ਕਿਤਾਬਾਂ ਹੀ ਪੜ੍ਹਦਾ ਹੁੰਦਾ ਪ੍ਰੇਰਿਤ ਤਾਂ ਮੈਨੂੰ ਆਪਣੇ ਆਪ ਨੇ ਹੀ ਕੀਤਾ ਲਿਖਣ ਦਾ ਸ਼ੌਂਕ ਮੈਨੂੰ ਸ਼ੁਰੂ ਤੋਂ ਸੀ ਬਚਪਨ ਤੋਂ ਹੀ ਲ ਲਿਖ ਲੈਂਦਾ ਉਦੋਂ ਮਾੜਾ ਮੋਟਾ ਲਿਖ ਲੈਂਦਾ ਸੀ ਹੁਣ ਚਲੋ ਵਧੀਆ ਲਿਖ ਲੈਂਦਾ ਅਤੇ ਬਚਪਨ ਤੋਂ ਹੀ ਮੈਂ ਲਿਖਣਾ ਸ਼ੁਰੂ ਕੀਤਾ ਸੀ ਅਤੇ ਅਤੇ ਹੁਣ ਮੈਂ ਜ਼ਿਆਦਾਤਰ ਵੈਸੇ ਆਪਣੀ ਮਾਂ ਬੋਲੀ 'ਚ ਲਿਖਦਾ ਪੰਜਾਬੀ 'ਚ ਲਿਖਦਾ ਮੈਂ ਪੰਜਾਬੀ 'ਚ ਲਿਖ ਕੇ ਮੈਨੂੰ ਸਕੂਨ ਮਿਲਦਾ ਹੈ ਅਤੇ ਪੰਜਾਬੀ 'ਚ ਲਿਖਣਾ ਵੀ ਪੰਜਾਬੀ 'ਚ ਵਧੀਆ ਲੱਗਦਾ ਹੋਰ ਭਾਸ਼ਾ 'ਚ ਹਿੰਦੀ 'ਚ ਵੈਸੇ ਕ ਲਿਖ ਲੈਂਦਾ ਮਾੜਾ ਮੋਟਾ ਪਰ ਜ਼ਿਆਦਾਤਰ ਪੰਜਾਬੀ 'ਚ ਲਿਖਦਾ ਸਾਰਾ ਕੁਛ ਜਿੱਦਾਂ ਗਾਣੇ ਜਾਂ ਕਵਿਤਾ ਇਹ ਪੰਜਾਬੀ 'ਚ ਲਿਖੇ ਹੋਈਆਂ ਨੇ ਹੁਣ ਤੱਕ ਜੇ ਕੋਈ ਵੈਸੇ ਡਿਮਾਂਡ ਕਰਦਾ ਹਿੰਦੀ 'ਚ ਲਿਖਣ ਦੀ ਤਾਂ ਮੈਂ ਹਿੰਦੀ 'ਚ ਵੀ ਲਿਖ ਲੈਂਦਾ ਬਸ ਦੋਹੇ ਭਾਸ਼ਾਵਾਂ ਨੇ ਪੰਜਾਬੀ ਜਾਣੀ ਮਾਂ ਬੋਲੀ 'ਚ ਵੱਧ ਲਿਖਦਾ ਅਤੇ ਉਹਦੇ ਨਾਲ ਆਪਾਂ ਨੂੰ ਜ਼ਿਆਦਾ ਲਗਾਵ ਆ ਮੇਰਾ